ਇਕ ਲੱਖ ਪੰਦਰ੍ਹਾਂ ਹਜ਼ਾਰ ਇੱਕ ਸੌ ਪੰਦਰ੍ਹਾਂ ਸੱਤ ਲੱਖ ਸਤਾਰ੍ਹਾਂ ਹਜ਼ਾਰ ਚਾਰ ਸੌ ਸਤਾਰ੍ਹਾਂ ਪੰਜ ਲੱਖ ਛਿਆਨਵੇਂ ਹਜ਼ਾਰ ਨੌ ਸੌ ਨੜੇਨਵੇਂ ਛੇ ਲੱਖ ਸੱਠ ਹਜ਼ਾਰ ਸੱਤ ਸੌ ਨੱਬੇ ਚਾਰ ਲੱਖ ਪੰਤਾਲੀ ਹਜ਼ਾਰ ਤਿੰਨ ਸੌ ਪੰਤਾਲੀ